ਅਸੀਂ ਜਦੋਂ ਹਜ਼ੂਰ ਸਾਹਿਬ ਗਏ ਤਾਂ ਉਹ ਫਸਟ ਕਲਾਸ ਏ ਸੀ ਸੀਟ ਦਾ ਸਾਨੂੰ ਅਸੀਂ ਬੁੱਕ ਕਰਵਾਈ ਹੋਈ ਸੀ ਜਿਹੜੀ ਸਾਡੀ ਬਟ ਸੀ ਸੀ ਟੂ ਉਹਦੇ ਵਿੱਚ ਸਾਨੂੰ ਬਹੁਤ ਵਧੀਆ ਸੀਟਾਂ ਮਿਲੀਆਂ ਉਹ ਪਰਦੇ ਲੱਗੇ ਹੋਏ ਸੀ ਕਿਸੇ ਕਿਸਮ ਦਾ ਵੀ ਸ਼ੋਰ ਕੋਈ ਉੱਥੇ ਚੀਜ਼ ਵੇਚਣ ਵਾਲਾ ਵੀ ਕੋਈ ਉਸ ਕੰਪਾਰਟਮੈਂਟ ਵਿੱਚ ਨਹੀਂ ਆਉਂਦਾ ਜਿਹਦੇ ਨਾਲ ਕਿ ਡਿਸਟਰਬੈਂਸ ਹੁੰਦੀ ਹੋਵੇ ਓ ਇੰਜਣ ਦੀ ਆਵਾਜ਼ ਨਹੀਂ ਸੀ ਆ ਰਹੀ ਪਹੀਏ ਆਪਣੇ ਟਰੈਕ 'ਤੇ ਪੂਰੇ ਚੱਲ ਰਹੇ ਸੀ ਜਿਹਦੇ ਨਾਲ ਕਿ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅਸੀਂ ਆਪਣੇ ਘਰ ਦੇ ਕਮਰੇ 'ਚ ਬੈਠੇ ਹੋਏ ਹਾਂ ਕਿ ਜਾਂ ਗੱਡੀ ਦੇ ਵਿੱਚ ਬੈਠੇ ਹੋਏ ਹਾਂ